ਮੈਂ ਕਈ ਹੀ ਸਮੂਹਾਂ ਦੀ ਹਿੱਸਾ ਰਹਿ ਚੁੱਕੀ ਹਾਂ ਜਿਵੇਂ ਕਿ ਡਾਂਸ ਸੀਗਿੰਗ ਦੇ ਵਰਗੇ ਅਲੱਗ ਅਲੱਗ ਸਮੂਹ ਮੈਂ ਜੁੜੀ ਹਾਂ ਲੇਕਿਨ ਅੱਜ ਤੱਕ ਮੈਂ ਕੋਈ ਵੀ ਰਨਿੰਗ ਜਾਂ ਦੌੜਨ ਵਾਲੇ ਸਮੂਹ ਦੇ ਨਾਲ ਨਹੀਂ ਜੁੜੀ ਕਿਉਂਕਿ ਸਾਡੇ ਕੋ ਸਾਡੇ ਪਿੰਡ ਦੇ ਵਿੱਚ ਇੱਕ ਗਰਾਊਂਡ ਵੀ ਹੈ ਲੇਕਿਨ ਕੋਈ ਵੀ ਇਹ ਇੰਨੇ ਬੰਦੇ ਨਹੀਂ ਹੁੰਦੇ ਹਨ ਕਿ ਜਿਹੜੇ ਕਿ ਦੌੜ ਲਾਉਣ ਕਿਉਂਕਿ ਇੱਥੇ ਕੁੜੀਆਂ ਦੇ ਦੌੜਨ ਨਾ ਘੱਟ ਹੀ ਹੁੰਦਾ ਹੈ ਅਤੇ ਸਾ ਇਸ ਲਈ ਥੋੜ੍ਹਾ ਜਿਹਾ ਸਾਨੂੰ ਕੰਮ ਕਰਨ ਜਾਂ ਦੌੜਨ 'ਚ ਪਰੇਸ਼ਾਨੀ ਹੁੰਦੀ ਹੈ ਲੇਕਿਨ ਮੈਂ ਵੀ ਦੌੜਨ ਦੇ ਸਮੂਹ ਨਾਲ ਜੁੜਾਂ ਜੁੜਨਾ ਚਾਹੁੰਦੀ ਹਾਂ ਅਤੇ ਕਿਉਂਕਿ ਸਾਡੇ ਇੱਧਰ ਦੇ ਹਰ ਇੱਕ ਸਮੂਹ ਦੇ ਵਿੱਚ ਕੋਈ ਨਾ ਕੋਈ ਖਾਸੀਅਤ ਹੁੰਦੀ ਹੀ ਹੈ ਜੇ ਅਸੀਂ ਦੌੜਨ ਵਾਲੇ ਸਮੂਹ ਨਾਲ ਜੁੜਦੇ ਹਾਂ ਅਤੇ ਸਾਨੂੰ ਇੱਕ ਅਲੱਗ ਹੀ ਤਰੀਕੇ ਦੀ ਕੰਪ ਕੰਪਨੀ ਮਿਲਦੀ ਹੈ ਕਿ ਜਿਹਦੇ ਨਾਲ ਸਾਡਾ ਉਤਸਾਹ ਵਧਦਾ ਹੈ ਲੋਕਾਂ ਦਾ ਉਤਸ਼ਾਹ ਵਧੇਗਾ ਜਿਹਦੇ ਨਾਲ ਸਾਡੇ ਸਰੀਰ ਦੇ ਵਿੱਚ ਫਿੱਟਨੈਸ ਦੀ ਫਿੱਟਨੈਸ ਵਧਦੀ ਹੈ ਅਤੇ ਦੂਜਿਆਂ ਦੇ ਨਾਲ ਸਾਨੂੰ ਕੰਮ ਕਰਨ ਦਾ ਉਤਸ਼ਾਹ ਵੀ ਵੱਧਦਾ ਹੈ ਸਾਡੇ ਸਰੀਰ ਦੇ ਵਿੱਚ ਹਰ ਇੱਕ ਤਰੀਕੇ ਦੀ ਕਮੀ ਪੂਰੀ ਹੁੰਦੀ ਹੈ ਜਿਹਦੇ ਨਾਲ ਸਾਡਾ ਸਰੀਰ ਤੰਦਰੁਸਤ ਅਤੇ ਸਵ ਸਵੱਸਥ ਰਹਿੰਦਾ ਹੈ